ਹਾਂਜੀ ਸਰ ਤੁਹਾਡਾ ਨੰਬਰ ਮਿਲਿਆ ਸੀ ਮੈਂ ਇੱਥੇ ਨਾ ਤੁਹਾਡੇ ਸ਼ਹਿਰ ਘੁੰਮਣ ਆਉਣ ਲੱਗਿਆ ਸੀ ਤਾਂ ਮੈਂ ਹੋਟਲ ਦੇ ਬਾਰੇ ਪਤਾ ਕਰਨਾ ਸੀ ਕਿ ਕਿਹੜੇ ਕਿਹੜੇ ਹੋਟਲ ਨੇ ਕੀ ਕੀ ਰੇਟ ਨੇ ਕਿਵੇਂ ਕਿਵੇਂ ਹਾਂਜੀ ਬਜਟ ਬਜਟ ਦੀ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਬਸ ਹੋਟਲ ਵਧੀਆ ਹੋਣਾ ਚਾਹੀਦਾ ਹੈ ਅਤੇ ਹਾਂਜੀ ਹਾਂਜੀ ਠੀਕ ਹੈ ਜੀ

ਬਸ ਸਟੈਂਡ ਤੋਂ ਕਿੰਨੀ ਦੂਰ ਨੇ ਤਿੰਨੋਂ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਦੋ ਤਿੰਨ ਦਿੰਨ ਰੁਕਣਾ ਹੈ ਇੱਥੇ ਅਤੇ ਤਿੰਨ ਦਿੰਨ ਦੇ ਹਿਸਾਬ ਅਤੇ ਮੈਨੂੰ ਖਾਣਾ ਵੀ ਮੈਂ ਹੋਟਲ ਤੋਂ ਹੀ ਖਾਵਾਂਗਾ ਕਮਰਾ ਕਮਰੇ ਵੀ ਅਗਰ ਕੰਫਰਟੇਬਲ ਹੋਣ ਤਾਂ ਜ਼ਿਆਦਾ ਸਹੀ ਰਹੇਗਾ ਹਾਂਜੀ ਹਮ ਸਾਰੇ ਵੇਜ ਨੇ ਕਿ ਨੋਨ ਵੇਜ ਅਵੇਲੇਬਲ ਹੈ ਅੱਛਾ ਠੀਕ ਹੈ ਜੀ ਹਮ ਹਮ ਠੀਕ ਹੈ ਇਹ ਉਹੀ ਹੈ ਨਾ ਜਿਹੜਾ ਬਸ ਸਟੈਂਡ ਦੇ ਨੇੜੇ ਹੈ ਹਾਂਜੀ ਅਤੇ ਰੇਲਵੇ ਸਟੇਸ਼ਨ ਮੈਂ ਨਾ ਜਿਵੇਂ ਟਰੇਨ 'ਤੇ ਆਵਾਂਗਾ ਬਸ 'ਤੇ ਤਾਂ ਮੈਂ ਫਿਰ ਅੱਗੇ ਜਾਣਾ ਹੈ ਅਤੇ ਟਰੇਨ ਤੋਂ ਕਿੰਨਾ ਕੁ ਦੂਰ ਹੋਏਗਾ ਅਤੇ ਇਹ ਪਿਕਅਪ ਦਿੰਦੇ ਹੈ ਜਿਵੇਂ ਟਰੇਨ ਠੀਕ ਇੱਥੇ ਹੋਟਲ ਪਿਕਅਪ ਪਰੋਵਾਈਡ ਕਰਦੇ ਕਿ ਉੱਥੇ ਕੋਈ ਲੈਣ ਆਵੇਗਾ ਜਾਂ ਛੱਡਣ ਜਾਵੇਗਾ ਹਾਂਜੀ ਤਿੰਨ ਦਿਨਾਂ ਲਈ ਤਿੰਨ ਰਾਤ ਲਈ ਹਾਂ ਤੁਸੀਂ ਈ ਤੁਸੀਂ ਮੈਨੂੰ ਦੱਸ ਸਕਦੇ ਰੇਟ ਕੀ ਹੈ ਫਿਰ ਪਰ ਨਾਈਟ ਦਾ ਠੀਕ ਹੈ ਜੀ ਤੇ ਤੁਸੀਂ ਮੈਨੂੰ ਨੰਬਰ ਭੇਜ ਦਿਉ ਇਸ ਨੰਬਰ 'ਤੇ ਉਹਦਾ ਬੁਕਿੰਗ ਵਾਸਤੇ ਤਾਜ ਦੀ ਅਤੇ ਗੁਰਮਤ ਤਿੰਨੋਂ ਹੋਟਲ ਦੀ ਭੇਜ ਦਿਉ ਹਾਂਜੀ ਠੀਕ ਹੈ